ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਲੋ

ਹੈਲੋ ਨਸਮਤੇ ਜੀ ਠੀਕ ਹੈ ਜੀ ਹੁਸ਼ਿਆਰਪੁਰ ਦੇ ਤੁਹਾਨੂੰ ਮੈਂ ਹੁਸ਼ਿਆਰਪੁਰ ਦੇ ਫੇਮਸ ਜਿਹੜੇ ਫੂਡ ਸਟਰੀਟ ਆ ਪਹਿਲਾਂ ਉਹਦੇ ਬਾਰੇ ਦੱਸਦਾ ਇਹ ਹੈਗੀ ਆਪਣੇ ਮਾਲ ਰੋਡ ਜਿੱਥੇ ਕਚਹਿਰੀਆਂ ਆ ਉੱਥੇ ਨਾ ਹੁਸ਼ਿਆਰਪੁਰ ਦੇ ਵਿੱਚ ਪੂਰੀ ਸਟਰੀਟ ਏ ਬਣੀ ਓਹ ਆ ਫੂਡ ਦੀ ਫੂਡ ਸਟਰੀਟ ਦੇ ਨਾਮ 'ਤੇ ਫੇਮਸ ਆ ਉਹ ਉੱਥੇ ਤੁਹਾਨੂੰ ਵੈਜ ਨੋਨ ਵੈਜ ਸਾਰਾ ਕੁਛ ਹੀ ਮਿਲ ਜਾਣਾ ਵੈਜ ਰੈਪ ਮਿਲ ਜਾਣੇ ਆ ਸੈਂਡਵਿਚਿਸ ਮਿਲ ਜਾਣੇ ਆ ਬਰਗਰ ਮਿਲ ਜਾਣੇ ਆ ਠੀਕ ਆ ਪੀਜ਼ਾ ਸਭ ਕੁਛ ਉੱਥੇ ਤੁਹਾਨੂੰ ਮਿਲ ਜਾਣਾ ਅਤੇ ਹਾਂ ਹੈਗੇ ਵੀ ਸਸਤੇ ਆ ਅਤੇ ਬਹੁਤ ਦੂਰੋਂ ਦੂਰੋਂ ਲੋਕ ਉੱਥੋਂ ਖਾਣ ਆਉਂਦੇ ਆ ਹਾਂਜੀ ਜਿੱਦਾਂ ਰੇੜੀਆਂ ਲੱਗੀਆਂ ਹੁੰਦੀਆਂ ਨਾ ਸਾਈਡ ਸਟਰੀਟ 'ਤੇ ਉਦਾਂ ਏ ਆ ਇੱਕ ਤਾਂ ਜਿਹੜਾ ਤੁਹਾਡਾ ਦਿਲ ਕਰਦਾ ਦੂਜੀ ਦੇ ਜਾ ਸਕਦੇ ਹਾਂ ਅਤੇ ਤੀਜੀ 'ਤੇ ਜਾ ਸਕਦੇ ਹਾਂ ਹਾਂ ਰੇਟ ਸੌ ਰੁਪਏ ਤੋਂ ਥੱਲੇ ਥੱਲੇ ਹੀ ਆ ਉੱਥੇ ਅਤੇ ਫੇਰ ਜੇ ਤੁਸੀਂ ਅੱਗੇ ਜਾਣਾ ਰੈਸਟੋਰੈਂਟ ਫੇਰ ਹੁਸ਼ਿਆਰਪੁਰ ਘੰਟਾ ਘਰ ਵੱਲ ਚੱਲ ਜੋ ਉੱਥੇ ਆ ਜਾਂਦਾ ਦੂਜਾ ਉਹ ਕੀ ਨਾਮ ਉਹਦਾ ਆ ਜਿਹੜੇ ਉਹ ਬਣਦੇ ਹੁੰਦੇ ਆ ਸੋਇਆਬੀਨ ਦੇ ਕੀ ਕਹਿੰਦੇ ਉਹਨੂੰ ਮੋ ਨਹੀਂ ਨਹੀਂ ਮੋਮਜ਼ ਨਹੀਂ ਜਿਹੜੇ ਮੋਮਜ਼ ਵੀ ਨਹੀਂ ਉਹ ਹੁੰਦੇ ਆ ਇਹ ਨਿਊਟਰੀ ਨਿਊਟਰੀ ਕੁਛ ਇਹ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹਾਂ ਉਹ ਵੀ ਉਹਨਾਂ 'ਚ ਹਾਂ ਸੋਇਆ ਚਾਪ ਸੋਇਆ ਕੈਫੇ ਆ ਉਹਨਾਂ ਦਾ ਨਾਮ ਸੋਇਆ ਕੈਫੇ ਆ ਉੱਥੇ ਤੁਹਾਨੂੰ ਸੋਏ ਤੋਂ ਬਣੀਆਂ ਸਾਰੀਆਂ ਐਟਮਾਂ ਮਿਲ ਜਾਣੀਆਂ ਵੈਜ ਆ ਉਹ ਉਹਨੂੰ ਕਹਿੰਦੇ ਸੋਇਆ ਕੈਫੇ ਜਿਵੇਂ ਆਪਾਂ ਹੁਸ਼ਿਆਰਪੁਰ ਘੰਟਾ ਘਰ ਤੋਂ ਸ਼ੈਸਨ ਚੌਂਕ ਵੱਲ ਜਾਂਦੇ ਆਂ ਤਾਂ ਉਹਦੇ ਰਾਈਟ ਸਾਈਡ ਦੇ ਉੱਤੇ ਸੋਇਆ ਕੈਫੇ ਆ ਉੱਚੀ ਜੀ ਦੁਕਾਨ ਬਣੀ ਓ ਬਹੁਤ ਫੇਸਮ ਆ ਉੱਥੇ ਵੀ ਬਹੁਤ ਲੋਕ ਜਾਂਦੇ ਆ ਉਹ ਥੋੜ੍ਹਾ ਮਹਿੰਗਾ ਆ ਜਾਂਦਾ ਆ ਹਾਂ ਹਾਂ ਬਰਡੇ ਪਾਰਟੀ ਵੀ ਅਰੇਂਜ ਕਰ ਦਿੰਦੇ ਉਹ ਹਾਂ ਰੈਸਟੋਰੈਂਟ ਆ ਨਾ ਉਹ ਫੇਰ ਇਸ ਤੋਂ ਬਾਅਦ ਆਪਣੇ ਹੁਸ਼ਿਆਰਪੁਰ ਬੱਸ ਸਟੈਂਡ ਚੱਲ ਜੋ ਉੱਥੇ ਤੁਹਾਨੂੰ ਇੱਕ ਰੈਸਟੋਰੈਂਟ ਹੈਗਾ ਡੋਮੀਨੋਜ਼ ਪੀਜ਼ਾ ਉਹ ਵੀ ਮਹਿੰਗਾ ਆ ਉਹ ਵੀ ਤੁਸੀਂ ਜਾ ਕੇ ਉੱਥੇ ਬੈਠ ਸਕਦੇ ਹਾਂ ਫੁੱਲੀ ਏਸੀ ਆ ਅਤੇ ਪਾਰਕਿੰਗ ਲਈ ਵੀ ਹੈਗਾ ਤੁਸੀਂ ਗੱਡੀ ਵਗੈਰਾ ਲਾ ਸਕਦੇ ਆਪਣੀ ਅਤੇ ਉੱਥੇ ਓਨਲੀ ਪੀਜ਼ਾ ਹੀ ਮਿਲਣਾ ਪੀਜ਼ੇ ਦੀਆਂ ਵਰੈਟੀਆਂ ਹੁੰਦੀਆਂ ਉੱਥੇ ਜ਼ਿਆਦਾ ਅੱਛਾ ਸੌ ਰੁਪਏ ਤੋਂ ਸਟਾਰਟ ਹੋ ਜਾਂਦਾ ਛੋਟਾ ਜਿਹੜਾ ਸਮੋਲ ਸਾਈਜ਼ ਆ ਫਿਰ ਮੀਡੀਅਮ ਆ ਜਾਂਦਾ ਲਾਰਜ ਆ ਜਾਂਦਾ ਹਾਂ ਸਾਰੇ ਮਿਲ ਜਾਂਦੇ ਫੇਰ ਉਸ ਤੋਂ ਬਾਅਦ ਇੱਕ ਆਪਣੇ ਹੁਸ਼ਿਆਰਪੁਰ ਤੋਂ ਜਲੰਧਰ ਰੋਡ 'ਤੇ ਮੈਕਡੋਨਲ ਖੁੱਲ੍ਹ ਗਿਆ ਨਵੀਂ ਓਪਨਿੰਗ ਹੋਈ ਉਹਦੀ ਥੋੜ੍ਹੇ ਦਿਨ ਪਹਿਲਾਂ ਪੰਦਰ੍ਹਾਂ ਵੀਹ ਦਿਨ ਪਹਿਲਾਂ ਉੱਥੇ ਤੁਸੀਂ ਬਰਗਰ ਮੈਕਡੋਨਲ ਦੇ ਫਰੈਂਚ ਫਰਾਈਸ ਇਹੋ ਜਿਹੀਆਂ ਚੀਜ਼ਾਂ ਹਾਂ ਮਿਲ ਜਾਂਦਾ ਸਭ ਕੁਛ ਮਿਲ ਜਾਂਦਾ ਉਹਦੇ ਨਾਲ ਹੀ ਕੇਐਫਸੀ ਉਹ ਨੋਨ ਵੈਜ ਹੋ ਗਿਆ ਉਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਚੰਡੀਗੜ੍ਹ ਬਾਈਪਾਸ ਦੇ ਉੱਤੇ ਹੈਗਾ ਕੇਐਫਸੀ 'ਤੇ ਇੱਕ ਉੱਥੇ ਹੈਗਾ ਸਾਗਰ ਰਤਨਾ ਹੋਟਲ ਉੱਥੇ ਚਾਰ ਸੌ ਰੁਪਏ ਦੀ ਥਾਲੀ ਆ ਉਹਦੇ ਵਿੱਚ ਤੁਹਾਨੂੰ ਹਰੇਕ ਡੀਸ਼ ਤਕਰੀਬਨ ਚਾਰ ਪੰਜ ਡੀਸ਼ੀਸ ਦੇ ਦਿੰਦੇ ਆ ਚਾਰ ਸੌ ਰੁਪਏ ਦੀ ਥਾਲੀ ਆ ਉਹ ਸਾਗਰ ਰਤਨਾ ਜਿਹੜੀ ਹੋਟਲ ਦੀ ਬ੍ਰਾਂਚ ਹੈ ਨਾ ਉਹਨਾਂ ਨੇ ਹਾਂ ਚਾਵਲ ਦਿੰਦੇ ਰਾਈਸ ਵੀ ਹੁੰਦੇ ਉਹਦੇ ਵਿੱਚ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਤੁਸੀਂ ਦੇਖ ਲਓ ਮੈਨੂੰ ਫੋਨ ਕਰ ਲਿਓ ਓਕੇ ਜੀ ਥੈਂਕ ਯੂ